ਘੋੜਾ ਇੱਕ ਬਹੁਤ ਵਧੀਆ ਜਾਨਵਰ ਹੈ ਅਤੇ ਤੇਜ਼ ਭੱਜਣ ਵਾਲਾ ਆਵਾਜਾਈ ਦਾ ਸਾਧਨ ਹੈ ਇਸ ਦੀ ਦੇਖਭਾਲ ਸਾਨੂੰ ਇਸ ਨੂੰ ਰੋਜ਼ ਵਧੀਆ ਅਤੇ ਸਟਰੋਂਗ ਖੁਰਾਕ ਦੇਣੀ ਚਾਹੀਦੀ ਹੈ ਉਸਨੂੰ ਤਾਜ਼ਾ ਘਾਹ ਖਿਲਾਉਣਾ ਚਾਹੀਦਾ ਅਤੇ ਛੋਲੇ ਖਿਲਾਉਣੇ ਚਾਹੀਦੇ ਹਨ ਜਿਸ ਨਾਲ ਉਸਦਾ ਸਟੈਮੀਨਾ ਵਧੀਆ ਰਹਿੰਦਾ ਹੈ ਉਸ ਨੂੰ ਰੋਜ਼ ਨਲਾਉਣਾ ਚਾਹੀਦਾ ਹੈ ਅਤੇ ਉਸਨੂੰ ਸਾਫ ਸੁਥਰੇ ਵਾਤਾਵਰਨ ਵਿੱਚ ਰੱਖਣਾ ਚਾਹੀਦਾ ਹੈ ਉਸ ਦੀ ਖੁਰਾਕ ਵਿੱਚ ਨਿਊਟ੍ਰੀਸ਼ਨ ਦੀ ਮਾਤਰਾ ਭਰਪੂਰ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਰੋਜ਼ ਕਸਰਤ ਵੀ ਕਰਵਾਉਣੀ ਚਾਹੀਦੀ ਹੈ ਤਾਂ ਕਿ ਜੋ ਉਸਦਾ ਸੰਤੁਲਿ ਸੰਤੁਲਨ ਬਣਿਆ ਰਹੇ ਰੋਜ਼ ਸਵਾਰੀ ਕਰਨ ਤੋਂ ਪਹਿਲਾਂ ਘੋੜੇ ਦੀ ਮਾਲਸ਼ ਕਰਨੀ ਚਾਹੀਦੀ ਹੈ ਉਸਨੂੰ ਨਲਾਉਣ ਤੋਂ ਬਾਅਦ ਖੁੱਲ੍ਹਾ ਛੱਡਣਾ ਚਾਹੀਦਾ ਹੈ ਅਤੇ ਉਸਦੀ ਕਾਠੀ ਜਿਸ 'ਤੇ ਬੈਠ ਕੇ ਸਵਾਰੀ ਕਰਦੇ ਹਾਂ ਉਸ ਨੂੰ ਚੰਗੀ ਤਰ੍ਹਾਂ ਕੱਸਣਾ ਚਾਹੀਦਾ ਹੈ ਤਾਂ ਕਿ ਸਵਾਰੀ ਕਰਨ ਵਾਲਾ ਵਿਅਕਤੀ ਚੰਗੀ ਤਰ੍ਹਾਂ ਬੈਠੇ ਅਤੇ ਘੋੜੇ ਦੀ ਸਭ ਤੋਂ ਮੇਨ ਚੀਜ਼ ਉਸ ਦੇ ਪੈਰ ਪੈਰ ਉਹਨਾਂ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਉਹਨਾਂ ਦੇ ਸਹੀ ਤਰੀਕੇ ਨਾਲ ਖੁਰੀਆਂ ਲਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਘੋੜੇ ਨੂੰ ਭੱਜਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਕਿਉਂਕਿ ਘੋੜਾ ਖੁਰੀਆਂ ਤੋਂ ਬਿਨਾ ਨਹੀਂ ਭੱਜ ਸਕਦਾ ਉਸਦੇ ਪੈਰ ਪੱਕ ਜਾਂਦੇ ਹਨ ਜੋ ਕਿ ਉਸਨੂੰ ਬਹੁਤ ਤਕਲੀਫ ਦਿੰਦੇ ਹਨ